ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬੈਂਕਿੰਗ ਡਿਸਲਾਈਜੇਸ਼ਨ ਆਨਲਾਈਨ ਸਰਵਿਸਿਸ ਏ ਆਈ ਟੈਕਨੋਲੋਜੀ ਦੇ ਦੁਆਰਾ ਮੈਨੂੰਫੈਕਚਰਿੰਗ ਔਰ ਇਹ ਔਰ ਸਰਵਿਸਿਸ ਔਰ ਏ ਆਈ ਟੈਕਨੋਲਜੀ ਦੇ ਦੁਆਰਾ ਹੋਰ ਟ੍ਰੇਡਿੰਗ ਵਗੈਰਾ ਦੇ ਵਿੱਚ ਜੋ ਨਵੇਂ ਰੁਝਾਨ ਹੋਣਗੇ ਉਹਨਾਂ ਦੇ ਨਾਲ ਸਾਡੇ ਵਿੱਤੀ ਰੋਜ਼ਾਨਾ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ